ਸਾਡੇ ਜ਼ਿਲ੍ਹੇ ਵਿੱਚ ਸ਼ਹੀਦੀ ਅਸਥਾਨ ਹੈ ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਜਿੱਥੇ ਕਿ ਤਰਨਾ ਦਲ ਦੇ ਅਤੇ ਬੁੱਢਾ ਦਲ ਦੇ ਅੱਠਵੇਂ ਜੱਥੇਦਾਰ ਸ਼ਹੀਦ ਬਾਬਾ ਸਿੰਘ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਜਿਹੜੇ ਉਹਨਾਂ ਦੇ ਨਾਲ ਇਕਿਆਸੀ ਸਿੰਘ ਸ਼ਹੀਦ ਹੋਏ ਸੀਗੇ ਜੀ ਅਤੇ ਇੱਥੇ ਬੜੀ ਆਸਥਾ ਹੈ ਅਤੇ ਜਿਹੜੀ ਵਾ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਉਹ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਉੱਨੀ ਸੌ ਛਿਆਨਵੇਂ ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਤਾ ਜਿੱਥੇ ਬਹੁਤ ਜ਼ਿਆਦਾ ਮਤਲਬ ਆਸਥਾ ਲੋਕਾਂ ਦੀਆਂ ਜੁੜੀਆਂ ਹੋਈਆਂ ਮੋਹਾਲੀ ਜ਼ਿਲ੍ਹੇ ਦੀਆਂ ਜਾਂ ਪੂਰੇ ਪੰਜਾਬ ਦੀਆਂ ਇੰਡੀਆ ਲੈਵਲ ਆਲ ਵਰਡ ਦੀਆਂ ਉਹ ਤੋਂ ਬਾਅਦ ਸਾਡੇ ਜਿਹੜਾ ਲੰਬਿਆਂ ਪਿੰਡ ਸੀਗਾ ਆਲ ਆਲਮੋਸਟ ਬਹੁਤ ਜ਼ਿਆਦਾ ਪਹਿਲਾਂ ਦੀ ਗੱਲ ਹੈ ਇਹ ਜਿਹੜਾ ਹੁਣ ਅੱਠ ਫੇਜ਼ ਅੰਬ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਹਰਿਰਾਏ ਜੀ ਆਪਣੇ ਦੂਜੇ ਜਨਮ 'ਚ ਆਏ ਸੀਗੇ ਜੀ ਅਤੇ ਉੱਥੇ ਸਦਾਬਹਾਰ ਜਦੋਂ ਵੀ ਬੇਮੌਸਮੀ ਅੰਬ ਲੱਗਦੇ ਆ ਅੱਜ ਵੀ ਉਹ ਦਰੱਖਤ ਉੱਥੇ ਹੈਗਾ ਸ਼ੁਸ਼ੋਭਿਤ ਹੈ ਉੱਥੇ ਵੀ ਬੜੀ ਆਸਥਾ ਹੈ ਉਹ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਵਿੱਚ ਸ਼ੀਤਲਾ ਮਾਤਾ ਮੰਦਰ ਹੈ ਕੁਰਾਲੀ ਹੈ ਬਹਿਲੋਲਪੁਰ ਹੈ ਸਾਡੇ ਮੋਹਾਲੀ ਦੇ ਨਾਲ ਹੀ ਬਿਲਕੁਲ ਉੱਥੇ ਸ਼ੀਤਲਾ ਮਾਤਾ ਦਾ ਮੱਥਾ ਟੇਕਿਆ ਜਾਂਦਾ ਜਿਹਦੇ ਨਾਲ ਲੋਕਾਂ ਦੀ ਬਹੁਤ ਆਸਥਾ ਜੁੜੀ ਹੋਈ ਹੈ ਅਤੇ ਗੁਰੂ ਨਾਨਕ ਦੇਵ ਜੀ ਦੀ ਕੁੱਲ ਦੇ ਵਿੱਚੋਂ ਸਾਡੇ ਬਿਲਕੁਲ ਮੋਹਾਲੀ ਦੇ ਐਡਜੋਇਨਿੰਗ ਹੈ ਆਪਣਾ ਦਾਊਂ ਦਾਊਂ ਇੱਕੀਵੀਂ ਗੱਦੀ ਹੈ ਗੁਰੂ ਨਾਨਕ ਦੇਵ ਜੀ ਦੀ ਕੁਲ ਤੋਂ ਬਾਬਾ ਸ਼੍ਰੀ ਚੰਦ ਜੀ ਦੀ ਕੁਲ ਤੋਂ ਹੈ ਉੱਥੇ ਬੜੀ ਆਸਥਾ ਹੈ ਉਹਨਾਂ ਦੇ ਨਾਲ ਹੀ ਹਰੀਪੁਰ ਪੈਂਦਾ ਹਿਮਾਚਲ 'ਚ ਉਹ ਇਹਨਾਂ ਦਾ ਹੈਡ ਔਫਿਸ ਹੈ ਉੱਥੇ ਵੀ ਬਹੁਤ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਅਤੇ ਕਈ ਤਿਉਹਾਰ ਮਨਾਏ ਜਾਂਦੇ ਆ ਜਿਵੇਂ ਬਸੰਤ ਪੰਚਮੀ ਹੈ ਪਿੰਡ ਬੱਲੋ ਮਾਜਰਾ ਦੇ ਵਿੱਚ ਧੰਨ ਧੰਨ ਬਾਬਾ ਜਾਨਕੀ ਦਾਸ ਜੀ ਦਾ ਡੇਰਾ ਅਤੇ ਉੱਥੇ ਆਪਣਾ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਲੋਕ ਬਹੁਤ ਦੂਰ ਦੂਰ ਤੋਂ ਆਉਂਦੇ ਆ ਮਨਾਉਣ ਵਾਸਤੇ ਅਤੇ ਛਿੰਝ ਦਾ ਮੇਲਾ ਕਰਾਇਆ ਜਾਂਦਾ ਆਲਮੋਸਟ ਬਹੁਤ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਜਾਂਦੇ ਹੈ ਅਤੇ